ਸਤਿ ਸ਼੍ਰੀ ਅਕਾਲ ਟੈਕਨਾਲੋਜੀ ਨੇ ਆਉਣ ਵਾਲੇ ਲੋਕਾਂ ਨੂੰ ਅਤੇ ਉਦਯੋਗਾਂ ਨੂੰ ਬਹੁਤ ਜ਼ਿਆਦਾ ਮਦਦ ਕੀਤੀ ਹੈ ਪਹਿਲਾਂ ਲੋਕਾਂ ਨੂੰ ਦੇਖਣਾ ਪੈਂਦਾ ਸੀ ਕਿ ਟਰੇਨ ਕਦੋਂ ਆਏਗੀ ਖੜ੍ਹੇ ਰਹਿੰਦੇ ਸੀ ਸਟੇਸ਼ਨ 'ਤੇ ਹੁਣ ਲੋਕ ਟਰੇਨਾਂ ਦੇ ਐਪ ਬਣੇ ਹੋਏ ਆ ਜਿੱਥੇ ਉਹ ਆਪਣੀ ਟਰੇਨ ਦੀ ਸੀਟ ਨੂੰ ਬੁੱਕ ਵੀ ਕਰ ਸਕਦੇ ਆ ਅਤੇ ਇਕਦਮ ਸਮੇਂ 'ਤੇ ਦੇਖ ਸਕਦੇ ਹੈ ਕਿ ਟਰੇਨ ਕਿੱਥੇ ਖੜ੍ਹੀ ਹੈ ਕਿਹੜੇ ਸਟੇਸ਼ਨ 'ਤੇ ਖੜ੍ਹੀ ਹੈ ਅਤੇ ਕਿੰਨੇ ਵਜੇ ਉਹਨਾਂ ਦੇ ਸਟੇਸ਼ਨ 'ਤੇ ਆਏਗੀ ਅਤੇ ਉਸੇ ਆਧਾਰਿਤ 'ਤੇ ਅਤੇ ਉਸੇ ਅਨੁਸਾਰ ਉਹ ਆਪਣੇ ਘਰੋਂ ਤੋਂ ਬਾਹਰ ਨਿਕਲਦੇ ਆ ਅੱਜ ਕੱਲ੍ਹ ਫਲਾਈਟਾਂ ਲਈ ਵੀ ਬੱਸਾਂ ਲਈ ਵੀ ਤਾਂ ਕਿੰਨੇ ਐਪ ਚੱਲ ਪਏ ਹੈ ਜਿਨ੍ਹਾਂ 'ਚ ਲੋਕ ਘਰ ਬੈਠੇ ਬੈਠੇ ਟਿਕਟ ਬੁੱਕ ਕਰ ਸਕਦੇ ਆ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਆ ਰੇਲਗੱਡੀਆਂ ਦੀ ਸਥਿਤੀਆਂ ਦੀ ਜਾਂਚ ਕਰਨ ਲਈ ਅਤੇ ਦੂਜੀ ਕਈ ਵਾਰ ਹੁੰਦਾ ਹੈ ਕਿ ਲੋਕ ਆਪਣਾ ਪੋਸਟ ਭੇਜਦੇ ਆ ਕੁਰੀਅਰ ਭੇਜਦੇ ਆ ਉਹਦੀ ਦੇਖਣ ਲਈ ਵੀ ਕਿ ਕਿੱਥੇ ਤੱਕ ਸਾਡਾ ਕੂਰੀਅਰ ਪਹੁੰਚ ਗਿਆ ਹੈ ਅਤੇ ਕਿੱਧਰ ਨਹੀਂ ਪਹੁੰਚਿਆ ਹੈ ਅੱਜ ਕੱਲ੍ਹ ਲੋਕ ਘਰ ਬੈਠੇ ਬੈਠੇ ਔਨਲਾਈਨ ਲਾਈਸੈਂਸ ਵੀ ਪ੍ਰਾਪਤ ਕਰ ਸਕਦੇ ਆ ਪਹਿਲੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਹੁਣ ਇੱਥੇ ਹੀ ਫੋਰਮ ਅਪਲਾਈ ਕਰਦੇ ਆ ਅਤੇ ਘਰ ਆ ਕੇ ਉਹਨਾਂ ਦੇ ਪਹੁੰਚ ਜਾਂਦਾ ਹੈ ਕੋਵਿਡ ਕਾਲ 'ਚ ਤਾਂ ਬਹੁਤ ਜ਼ਿਆਦਾ ਤੈਕਨਾਲੋਜੀ ਦਾ ਉਪਯੋਗ ਰਿਹਾ ਸੀ ਧੰਨਵਾਦ